ਹੈਲੋ ਹੈਲੋ ਹਾਂਜੀ ਕੀ ਹਾਲ ਚਾਲ ਹਾਂਜੀ ਹਾਂ ਵਧੀਆ ਮੈਂ ਇੱਦਾਂ ਕਹਿੰਦੀ ਸੀਗੀ ਹੁਣ ਆਪਣੇ ਸਮੈਸਟਰ ਦਾ ਵੀ ਲਾਸਟ ਪੇਪਰ ਰਹਿ ਗਿਆ ਅਤੇ ਆਪਣੀ ਗ੍ਰੈਜੂਏਸ਼ਨ ਖ਼ਤਮ ਹੀ ਹੋਣ ਵਾਲੀ ਹੈ ਤਾਂ ਆਪਾਂ ਕੁਛ ਬਿਜਨਸ ਵਗੈਰਾ ਬਾਰੇ ਸੋਚੀਏ ਹਾਂਜੀ ਹਾਂ ਕਿਉਂਕਿ ਗਵਰਨਮੈਂਟ ਜੋਬ ਦਾ ਵੀ ਕੁਛ ਹੈ ਨੀ ਏਡਾ ਹੈ ਨਹੀਂ ਤਾਂ ਹੁਣ ਆਪਾਂ ਬਿਜ਼ਨਸ ਬਾਰੇ ਹੀ ਸੋਚ ਲੈਂਦੇ ਹਾਂ ਵੀ ਕੋਈ ਕਰਦੇ ਹਾਂ ਸ਼ੁਰੂ ਮੈਂ ਜਿੱਦਾਂ ਹੁਣ ਕਾਫੀ ਬਾਹਰ ਜਾਣ ਦਾ ਬਹੁਤ ਚੱਲ ਰਿਹਾ ਹੈ ਨਾ ਤਾਂ ਫਿਰ ਆਪਾਂ ਇਮੀਗਰੇਸ਼ਨ ਦਾ ਕੰਮ ਨਾ ਕਰ ਲਈਏ ਸ਼ੁਰੂ ਹੈਗਾ ਤੁਹਾਨੂੰ ਆਈਡੀਆ ਹੈਗਾ ਕੋਈ ਹਾਂ ਇਹ ਤਾਂ ਹੈ

ਹਾਂ ਹਾਂ ਇਹ ਵੀ ਹੈ ਕਿਉਂਕਿ ਹੁਣ ਜਿੱਦਾਂ ਆਪਾਂ ਇਮੀਗ੍ਰੇਸ਼ਨ ਦਾ ਕਹਿ ਰਹੇ ਹਾਂ ਉਹਦੇ 'ਚ ਤਾਂ ਆਪਾਂ ਨੂੰ ਪਹਿਲਾਂ ਆਫਿਸ ਵੀ ਆਪਣਾ ਵੀ ਰਜਿਸਟਰ ਵਗੈਰਾ ਕਰਾਉਣਾ ਪਊਗਾ ਉਹਦਾ ਤਾਂ ਥੋੜ੍ਹਾ ਲੰਬਾ ਹੈ ਹਾਂ ਇਹ ਵੀ ਹੈ ਅੱਛਾ ਅੱਛਾ ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਹਾਂ ਠੀਕ ਹੈ ਹਾਂ ਕੋਈ ਨਹੀਂ ਆਪਾਂ ਮਿਲਦੇ ਹਾਂ ਫਿਰ ਪੇਪਰ ਤੋਂ ਬਾਅਦ ਫਿਰ ਆਪਾਂ ਡਿਸਕਸ ਕਰਾਂਗੇ ਹਾਂ ਠੀਕ ਹੈ ਓਕੇ